ਹੈਲੋ ਹਾਂਜੀ ਦੱਸੋ ਸੀਮਾ ਮੈਮ ਹਾਂ ਹਾਂ ਬਈ ਜਿਵੇਂ ਬੱਚਿਆਂ ਦੀ ਪੜ੍ਹਾਈ ਦਾ ਲੋਸ ਹੁੰਦਾ ਪਿਆ ਕਿੰਨੀਆਂ ਛੁੱਟੀਆਂ ਵਧੀ ਜਾਂਦੀਆਂ ਹੈਗੀਆਂ ਬਈ ਕਦੇ ਸਕੂਲ ਛੁੱਟੀ ਕਰਦਾ ਅਤੇ ਕਦੇ ਬੱਚੇ ਕਰਦੇ ਕਦੇ ਕੋਈ ਆਉਂਦਾ ਕਦੇ ਕੋਈ ਆਉਂਦਾ ਇਹਦਾ ਹਾਂ ਕੋਈ ਹੱਲ ਤਾਂ ਇਹਦੇ ਵਿੱਚ ਕੱਢਣਾ ਹੀ ਪੈਣਾ ਹੈ ਇੱਦਾਂ ਤਾਂ ਬੱਚਿਆਂ ਦਾ ਸਿਲੇਬਸ ਵੀ ਨਹੀਂ ਜਿਵੇਂ ਕਵਰ ਹੋਣਾ ਹੈ ਨਾ ਅਤੇ ਨਾ ਹੀ ਕਿਨਮ ਹੈਗਾ ਫੇਰ ਮਗਰੋਂ ਆਪਣੇ 'ਤੇ ਪਰੈਸ਼ਰ ਪੈ ਜਾਣਾ ਵੀ ਤੁਸੀਂ ਕਵਰ ਨਹੀਂ ਕਰਵਾਇਆ ਸਿਲੇਬਸ ਕਵਰ ਨਹੀਂ ਕਰਵਾਇਆ ਹਾਂ ਇੱਦਾਂ ਤਾਂ ਬੱਚੇ ਬੱਚੇ ਆਉਂਦੇ ਵੀ ਨਹੀਂ ਬੱਚੇ ਬਈ ਕਿਨਮ ਮੀਂਹ ਦੇ ਵਿੱਚ ਪੇਰੈਂਟਸ ਵੀ ਪਰੇਸ਼ਾਨ ਹੁੰਦੇ ਆ ਬਈ ਬੱਚਿਆਂ ਦੀ ਕਿਨਮ ਸਿਹਤ ਦੇ ਵਿੱਚ ਵੀ ਦੇਖਦੇ ਸਿਹਤ ਵੀ ਦੇਖਦੇ ਆ ਅਗਲੇ ਕਹਿੰਦੇ ਹੈਗੇ ਵੀ ਇੰਨਾ ਮਨਾ ਮੌਸਮ ਵੀ ਇੱਦਾਂ ਦਾ ਹੋਇਆ ਪਿਆ ਹੈਗਾ ਇਹਦਾ ਕੋਈ ਹੱਲ ਤਾਂ ਕੱਢ ਕੱਢਣਾ ਹੀ ਪੈਣਾ ਹੈਗਾ ਆਪਾਂ ਨੂੰ ਆਪਾਂ ਹੋਰ ਵੀ ਟੀਚਰ ਨਾਲ ਗੱਲ ਕਰਕੇ ਦੇਖ ਲੈਂਦੇ ਹਾਂ ਬਈ ਉਹ ਕੀ ਗੱਲ ਕਰਦੇ ਹੈਗੇ ਆ ਬਈ ਕੀ ਕੀ ਸਜੇਸ਼ਨ ਦਿੰਦੇ ਆ ਆਪਾਂ ਨੂੰ ਵੈਸੇ ਮੇਰੇ ਹਿਸਾਬ ਨਾਲ ਤਾਂ ਜਿਵੇਂ ਆਪਾਂ ਆਨਲਾਈਨ ਕਲਾਸਿਸ ਸ਼ੁਰੂ ਕਰਵਾ ਲਈਏ ਜਿਵੇਂ ਆਨਲਾਈਨ ਕਲਾਸ ਵਿੱਚ ਬੱਚਿਆਂ ਦੀ ਛੁੱਟੀ ਵੀ ਨਹੀਂ ਹੋਊਗੀ ਸਿਲੇਬਸ ਵੀ ਕਵਰ ਹੋ ਜਾਊਗਾ ਕਿ ਨਹੀਂ ਇੱਦਾਂ ਕਰ ਕਰ ਸਕਦੇ ਹਾਂ ਆਪਾਂ ਪ੍ਰਿੰਸੀਪਲ ਮੈਡਮ ਨਾਲ ਜਦੋਂ ਜਿਵੇਂ ਆਪਣੀ ਕੋਈ ਮੀਟਿੰਗ ਬਿਠਾਉਂਦੀ ਆ ਮੈਡਮ ਜਾਂ ਫਿਰ ਆਪਾਂ ਟੀਚਰਸ ਦੂਸਰੇ ਟੀਚਰ ਨਾਲ ਗੱਲ ਕਰਕੇ ਬਈ ਇੱਦਾਂ ਕਹਿ ਸਕਦੇ ਹੋ ਪੁੱਛ ਸਕਦੇ ਹੋ ਪੁੱਛਣ ਨੂੰ ਤਾਂ ਕੀ ਆਪਾਂ ਨੂੰ ਹਾਂ ਇਹ ਤਾਂ ਹੈ ਉਹ ਤਾਂ ਦੇਖਣਾ ਆਪਾਂ ਕੀ ਦੇਖਣਾ ਹੁਣ ਦੇਖੋ ਵੀ ਵੇਖਦੇ ਹਾਂ ਆਪਾਂ ਬਾਕੀ ਟੀਚਰ ਨਾਲ ਲੰਚ ਟਾਈਮ ਅਤੇ ਗੱਲ ਕਰ ਲੈਂਦੇ ਹਾਂ ਦੇਖਦੇ ਹਾਂ ਬਈ ਕਿਵੇਂ ਕੀ ਕਹਿੰਦੇ ਆਪਾਂ ਨੂੰ ਉਹ ਹਾਂ ਹਾਂ ਹਾਂ ਹਾਂ ਉਹੀ ਤਾਂ ਕਹਿੰਦੇ ਹਾਂ ਬਈ ਆਨਲਾਈਨ ਕਲਾਸਿਸ ਨਾਲ ਆਪਣਾ ਸਿਲੇਬਸ ਵੀ ਕਵਰ ਹੋ ਜਾਊਗਾ ਜਿਵੇਂ ਅਤੇ ਨਾਲੇ ਬੱਚਿਆਂ ਫਿਰ ਚਾਹੇ ਛੁੱਟੀ ਹੋਵੇ ਜਾਂ ਨਾ ਹੋਵੇ ਫਿਰ ਆਪਾਂ ਨੂੰ ਕੀ ਟੈਨਸ਼ਨ ਬੱਚਾ ਕੋਈ ਆਉਂਦਾ ਜਾਂ ਮਲਬ ਪ੍ਰੋਪਰ ਕਿਨਮ ਹੈਗਾ ਏ ਬੱਚਿਆਂ ਦੀ ਪੜ੍ਹਾਈ ਚੱਲਦੀ ਰਹੂਗੀ ਹਾਂ ਹਾਂ ਹਾਂ ਫਿਰ ਤਾਂ ਸਾਰੇ ਸਾਰਾ ਹੀ ਹੋਜੂਗਾ ਨਾ ਫਿਰ ਤਾਂ ਕਿਨਮ ਹੈਗਾ ਆ ਕਲਾਸਿਸ ਵੀ ਲੱਗਿਆ ਕਰੂਗੀ ਹੋਮਵਰਕ ਤਾਂ ਆਨਲ ਆਪਾਂ ਵਟਸਐਪ 'ਤੇ ਭੇਜ ਹੀ ਦਿੰਦੇ ਹੈਗੇ ਹਾਂ ਹਾਂ ਉਹ ਤਾਂ ਠੀਕ ਹੈ ਚਲੋ ਬਾਕੀ ਵੇਖਦੇ ਹਾਂ ਫਿਰ ਆਪਾਂ ਹੁਣ ਲੰਚ ਟਾਈਮ ਅਤੇ ਹਾਂ ਪਹਿਲਾਂ ਆਪਾਂ ਇੱਕ ਵਾਰੀ ਟੀਚਰ ਤਾਂ ਰਾਇ ਕਰ ਲਈਏ ਸਾਰੇ ਆਪਾਂ ਦੇਖ ਲੈਂਦੇ ਦੂਸਰੀ ਮੈਮ ਨੂੰ ਵੀ ਪੁੱਛ ਲੈਂਦੇ ਹਾਂ ਉਹ ਮੈਡਮ ਕੀ ਕਹਿੰਦੇ ਆ ਅਤੇ ਫਿਰ ਆਪਾਂ ਪ੍ਰਿੰਸੀਪਲ ਮੈਮ ਨਾਲ ਕਿਨਮ ਹੈਗੇ ਆਪਾਂ ਕੱਲ ਜਾਂ ਪਰਸੋਂ ਤੱਕ ਮੀਟਿੰਗ ਬਿਠਾ ਲੈਂਦੇ ਹਾਂ ਫਿਰ ਮੈਡਮ ਨਾਲ ਰਾਇ ਕਰਕੇ ਅਤੇ ਫਿਰ ਆਪਾਂ ਕਿਨਮ ਹੈਗੇ ਆ ਮੈਸੇਜ ਪਾ ਦੇਈਏ ਫੋਨ 'ਤੇ ਠੀਕ ਹੈ ਨਹੀਂ ਉਹਨਾਂ ਨੂੰ ਤਾਂ ਹਜੇ ਆਪਾਂ ਕੀ ਕਹਿਣਾ ਹੈਗਾ ਆਪਾਂ ਕਿਨਮ ਹੈਗੇ ਹੈ ਬਈ ਜੇ ਕੋਈ ਫੋਨ ਆਉਂਦਾ ਵੀ ਤਾਂ ਆਪਾਂ ਕਹਿ ਸਕਦੇ ਹਾਂ ਕੋਈ ਗੱਲ ਨਹੀਂ ਅਸੀਂ ਤੁਹਾਡਾ ਹੱਲ ਕਰਾਂਗੇ ਬਈ ਮੈਡਮ ਨਾਲ ਪ੍ਰਿੰਸੀਪਲ ਮੈਮ ਨਾਲ ਗੱਲ ਕਰਕੇ ਠੀਕ ਹੈ ਹਾਂ ਓਕੇ ਓਕੇ ਓਕੇ